ਹੈਲੋ ਹਾਂ ਬੇਬੀ ਕਿਵੇਂ ਆ ਹਾਂ ਮੈਂ ਵੀ ਵਧੀਆ ਠੀਕ ਠਾਕ ਹੋਰ ਸੁਣਾਓ ਅੱਛਾ ਘਰ ਪਹੁੰਚ ਗਈ ਅੱਛਾ ਹਾਂ ਮੈਂ ਤਾਂ ਪਹੁੰਚ ਗਈ ਸੀ ਬਸ ਸਿੱਧੀ ਟਰੇਨ ਲੈਣੀ ਹੁੰਦੀ ਫਤਿਹਗੜ੍ਹ ਸਾਹਿਬ ਤੋਂ ਹਾਂਜੀ ਤੁਸੀਂ ਦੱਸੋ ਘਰ ਸ਼ਾਮ ਨੂੰ ਟਰੇਨ ਮਿਲ ਜਾਂਦੀ ਆ ਟਾਈਮ ਨਾਲ ਸਵੇਰੇ ਹੁਣ ਧੁੰਦਾਂ ਪੈ ਹੀ ਜਾਂਦੀਆਂ ਨੇ ਹੈਗੀਆਂ ਉਹਦੇ ਕਰਕੇ ਫਿਰ ਮੈਨੂੰ ਥੋੜ੍ਹੀ ਦਿੱਕਤ ਆਉਂਦੀ ਹੈ ਟ੍ਰੇਨ ਦੀ ਲੇਟ ਹੋ ਜਾਂਦੀ ਆ ਕਈ ਵਾਰ ਕਈ ਵਾਰ ਤਾਂ ਟਾਈਮ ਨਾਲ ਆ ਜਾਂਦੀ ਹੈ ਫਿਰ ਮੈਂ ਟਾਈਮ ਨਾਲ ਟਰੇਨ ਚੜ੍ਹ ਜਾਂਦੀ ਹਾਂ ਜੇ ਨਹੀਂ ਆਉਂਦੀ ਹੈਗੀ ਫਿਰ ਪੀ ਆਰ ਟੀ ਸੀ ਬਸਿਸ ਬਹੁਤ ਆਉਂਦੀਆਂ ਨੇ ਹੈਗੀਆਂ ਲੋਕਲ ਫਤਿਹਗੜ੍ਹ ਸਾਹਿਬ ਦੀਆਂ ਅਤੇ ਜਲਦੀ ਪਹੁੰਚ ਜਾਂਦੇ ਹਾਂ ਵੈਸੇ ਉਂਝ ਫਸਲਿਟੀ ਵਧੀਆ ਹੈ ਫਤਿਹਗੜ੍ਹ ਸਾਹਿਬ ਦੀ ਸਾਰੀਆਂ ਬਸਿਸ ਟਰੇਨ ਹਮ ਅੱਛਾ ਹਾਂ ਚੱਲੋ ਕੋਈ ਨਹੀਂ ਹਾਂ ਹਾਂ ਤੁਹਾਡੇ ਤਾਂ ਬਸੀ ਤੋਂ ਸਿੱਧੀ ਟਰੇਨ ਮਿਲਦੀ ਹੋਊਗੀ ਬਸ ਵੀ ਹੈ ਨਾ ਅੱਛਾ ਹਾਂ ਚੱਲ ਇਹ ਵੀ ਠੀਕ ਆ ਸਾਡਾ ਵੀ ਲੋਕਲ ਹੈ ਆ ਤਾਂ ਹੀ ਪਹੁੰਚ ਜਾਂਦੇ ਆ ਉੱਥੇ ਉੱਤਰੋ ਟ੍ਰੇਨ ਉੱਤਰੋ ਸਟੇਸ਼ਨ ਤੋਂ ਸਿੱਧਾ ਆਟੋ ਲੈ ਕੇ ਇੱਥੇ ਆ ਜਾਂਦੇ ਸੀ ਹੁਣ ਤਾਂ ਚੱਲੋ ਬਸ ਹੀ ਇੱਧਰ ਕੋਲਜ ਤੱਕ ਆਉਣ ਲੱਗ ਗਈ ਕੋਈ ਦਿੱਕਤ ਪਰੇਸ਼ਾਨੀ ਹੋਈ ਨਹੀਂ ਹੈਗੀ ਇਵੇਂ ਦੀ

ਅੱਛਾ ਠੀਕ ਚੱਲ ਠੀਕ ਆ ਫਿਰ ਬਾਅਦ 'ਚ ਕਰਦੇ ਹਾਂ ਗੱਲ ਚੱਲ ਠੀਕ ਓਕੇ